ਜਿਸ ਤਰ੍ਹਾਂ ਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜਾ ਅਸੀਂ ਬਹੁਤੇ ਲੋਕ ਹਾਂ ਤਾਂ ਉਹ ਅਸੀਂ ਖੇਤੀ ਦੇ ਉੱਤੇ ਨਿਰਭਰ ਹਾਂ ਅਤੇ ਖੇਤੀ ਦੇ ਨਾਲ ਸੰਬੰਧਿਤ ਸੰਦ ਜਿਵੇਂ ਕਿ ਲੁਹਾਰ ਜ਼ਿਆਦਾਤਰ ਬਣਾਉਂਦੇ ਹਨ ਕਹੀਆਂ ਕੁਹਾੜੇ ਹੋ ਗਏ ਤਰਖਾਣ ਤਰਖਾਣ ਅਤੇ ਲੁਹਾਰ ਹੀ ਜ਼ਿਆਦਾ ਬਣਾਉਂਦੇ ਹਨ ਤੋ ਸੋ ਜਿਹੜੇ ਖੇਤੀ ਦੇ ਸੰਦ ਹਨ ਸਾਡੀ ਪਛਾਣ ਚਿੰਨ੍ਹ ਵੀ ਹਨ ਕਿਉਂਕਿ ਅ ਸਾਡੀ ਖੇਤੀ ਨਾਲ ਸੰਬੰਧਿਤ ਇਹ ਪਛਾਣ ਚਿੰਨ੍ਹ ਜਿੱਦਾਂ ਕਿ ਕਹੀ ਵੀ ਇਹ ਸਾਡੀ ਖੇਤੀ ਨਾਲ ਸੰਬੰਧਿਤ ਹੈ ਖੁਰਪੇ ਵਗੈਰਾ ਜੋ ਵੀ ਬਣਾਉਂਦੇ ਹਨ ਉਹ ਇੱਕ ਸਾਡੀ ਇੱਕ ਕਲਾ ਹੈ ਅਤੇ ਜਿਸ ਤਰ੍ਹਾਂ ਕਿ ਸਾਡੇ ਤਿਉਹਾਰਾਂ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਤਿਉਹਾਰ ਨੇ ਉਹ ਫ਼ਸਲ ਪੱਕਣ ਤੋਂ ਬਾਅਦ ਵੱਢਣ ਤੋਂ ਬਾਅਦ ਹੀ ਆਉਂਦੇ ਨੇ ਜਿੱਦਾਂ ਕਿ ਵਿਸਾਖੀ ਦਾ ਤਿਉਹਾਰ ਹੈ ਉਹ ਫ਼ਸਲ ਵੱਢਣ ਤੋਂ ਬਾਅਦ ਆਉਂਦਾ ਹੈ ਸੋ ਕਿਸਾਨ ਕਿਸਾਨ ਕਿਸਾਨ ਨੇ ਜੋ ਉਹ ਆਪਣੇ ਕਿਸਾਨੀ ਜੀਵਨ 'ਚੋਂ ਸੈਲੀਬਰੇਸ਼ਨ ਵੀ ਵਿਸਾਖੀ ਦੇ ਤਿਉਹਾਰ ਨੂੰ ਹੀ ਕਰਦੇ ਹਨ ਸੋ ਇਸ ਤਰ੍ਹਾਂ ਸਾਡੇ ਮਤਲਬ ਕਿ ਜਿਹੜੇ ਪੰਜਾਬ ਦੇ ਵਿੱਚ ਤਰਖਾਣ ਹੋ ਗਏ ਲੁਹਾਰ ਹੋ ਗਏ ਜਾਂ ਕਿਸਾਨ ਲਾ ਲਓ ਇਹ ਸਾਰੇ ਕਲਾ ਦੇ ਖੇਤਰ ਵਿੱਚ ਆਉਂਦੇ ਹਨ ਅਤੇ ਸ਼ਿਲਪਕਾਰੀ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੀਆਂ ਮਾਤਾਵਾਂ ਵਗੈਰਾ ਬੀਬੀਆਂ ਜੋ ਔਰਤਾਂ ਨੇ ਉਹ ਪੱਖੀਆਂ ਬੁਣਦੀਆਂ ਹਨ ਮੰਜੇ ਬੁਣਦੀਆਂ ਹਨ ਕਢਾਈ ਦਾ ਸਿਲਾਈ ਦਾ ਕੰਮ ਫੁਲਕਾਰੀ ਬੁਣਨ ਦਾ ਕੰਮ ਕਰਦੀਆਂ ਹਨ ਸੋ ਇਸ ਤਰ੍ਹਾਂ ਮਤਲਬ ਕਿ ਉਹ ਇਹਨੂੰ ਉਹਨਾਂ ਦੀ ਇੱਕ ਸ਼ਿਲਪਕਾਰੀ ਹੈ ਇਹਨਾਂ ਨੂੰ ਇੱਕ ਕਲਾ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਅਤੇ ਇਹ ਸਾਡੀ ਇੱਕ ਸੱਭਿਆਚਾਰ ਦੇ ਵਿੱਚ ਮਤਲਬ ਕਿ ਪਛਾਣ ਚਿੰਨ੍ਹ ਨੇ ਅਤੇ ਸ ਸਾਡੀ ਵਿਰਾਸਤ ਵੀ ਨੇ ਸੋ ਇਹ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਵਿਰਾਸਤ ਦੇ ਵਿੱਚ